ਪੰਦਰਾਂ ਅਗਸਤ ਉੱਨੀ ਸੌ ਸੰਤਾਲੀ ਬਾਰਾਂ ਜੁਲਾਈ ਉੱਨੀ ਸੌ ਛਿਆਨਵੇਂ ਦੋ ਜੂਨ ਉੱਨੀ ਸੌ ਪੰਚਾਨਵੇਂ ਸਤਾਈ ਨਵੰਬਰ ਦੋ ਹਜ਼ਾਰ ਤੇਈ ਇੱਕ ਜਨਵਰੀ ਦੋ ਹਜ਼ਾਰ ਤੇਈ